ਮੈਂ ਹਰਜੀਤ ਕੌਰ ਗੁਰਦਾਸਪੁਰ ਤੋਂ ਬੋਲਦੀ ਆਂ ਸਤਿ ਸ਼੍ਰੀ ਅਕਾਲ ਤੇ ਅਹੀਂ ਸਵੇਰੇ ਉੱਠ ਕੇ ਪਹਿਲਾਂ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਨਹਾ ਧੋ ਕੇ ਤੇ ਸਿਮਰਣ ਕਰੀਦਾ ਵਾ ਵਾਹਿਗੁਰੂ ਦਾ ਨਾਂਅ ਲਈ ਦਾ ਉੱਠ ਕੇ ਪਹਿਲਾਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕਰੀਦਾ ਫੇਰ ਚੁਪਈ ਸਾਹਿਬ ਦਾ ਪਾਠ ਕਰ ਕੇ ਫੇਰ ਪਹਿਲਾਂ ਪਹਿਲਾਂ ਤਾਂ ਕਾਫ਼ੀ ਦਿੱਕਤ ਹੁੰਦੀ ਰਹੀ ਐ ਪੀ ਸਵੇਰੇ ਉੱਠਣਾ ਵੀ ਬੜਾ ਔਖਾ ਜਿਆ ਲੱਗਦਾ ਸੀ ਤੇ ਹੁਣ ਥੋੜੀ ਥੋੜੀ ਰੁਟੀਨ ਜਿਹੜੀ ਐ ਉਹ ਦੁਬਾਰਾ ਪੀ ਬਣੀ ਜਾਂਦੀ ਪਈ ਆ ਹੁਣ ਜਿੰਨੀ ਜਲਦੀ ਉੱਠ ਦੇ ਆਂ ਓਨਾ ਹੀ ਆਪਣਾ ਈ ਸਿਮਰਨ ਕਰ ਲੈਨੇ ਆਂ ਤੇ ਸਿਮਰਨ ਕਰਦੇ ਸਮੇਂ ਅਸੀਂ ਚੁਪਈ ਸੈਬ ਦਾ ਪਾਠ ਵੀ ਕਰ ਲੈਨੇ ਆਂ ਸੁਖਮਨੀ ਸਾਬ ਦਾ ਜਦੋਂ ਮਤਲਬ ਕੀ ਟਾਈਮ ਲੱਗ ਜਾਂਦਾ ਓਦੋਂ ਕਰ ਲਈ ਦਾ ਵਾ ਤੇ ਸਵੇਰੇ ਉਥੇ ਕੇ ਜਪੁਜੀ ਸਾਹਿਬ ਜੀ ਦਾ ਪਾਠ ਕਰ ਲਈ ਦਾ ਵਾ ਤੇ ਜਿਹੜਾ ਹੁਣ ਮਨ ਵਾ ਹੁਣ ਮਤਲਬ ਕੀ ਬਿਲਕੁਲ ਲੱਗਣ ਲੱਗ ਪਿਆ ਪੀ ਚਲੋ ਪਹਿਲਾਂ ਇਹੋ ਹੀ ਕੰਮ ਪਹਿਲਾਂ ਉੱਠ ਕੇ ਪੀ ਕਰੀਏ ਜਿਹੜਾ ਪਹਿਲਾਂ ਉਹੋ ਈ ਕੰਮ ਕਰੀਦਾ ਹੋਰ ਸ਼ਨੀ ਐਤਵਾਰ ਗੁਰਦਵਾਰੇ ਦਰਬਾਰ ਸਾਹਿਬ ਸ਼ਹੀਦਾਂ ਦੇ ਓਥੇ ਵੀ ਜਾਈਦਾ ਵਾ ਆ ਕੇ ਫਿਰ ਆਪਣਾ ਜਿਹੜਾ ਦਿਨਚ ਕੰਮ ਹੁੰਦਾ ਵਾ ਉਹ ਸ਼ੁਰੂ ਕਰ ਲਈ ਦਾ ਵਾ ਸਵੇਰੇ ਉੱਠ ਕੇ ਪਹਿਲਾਂ ਪਾਠ ਕਰਕੇ ਨਹਾ ਧੋ ਕੇ ਪਾਠ ਕਰਕੇ ਆਪਣਾ ਸਾਰਾ ਈ ਫਿਰ ਬੱਚਿਆਂ ਨੂੰ ਟਾਈਮ ਸਿਰ ਮਤਲਬ ਕੀ ਖਾਣਾ ਬਣਾ ਕੇ ਦੇਣ ਪਿੱਛੋਂ ਫਿਰ ਜਿੰਨਾ ਕ ਟਾਈਮ ਬੱਚਦਾ ਵਾ ਉਹਦੇ ਵਿੱਚ ਅਸੀਂ ਆਪਣਾ ਮਨ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜੱਪੀ ਜਾਈਦਾ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੀ ਜਾਈਦਾ ਜੇ ਦੁਪਹਿਰੇ ਟਾਈਮ ਲੱਗੇ ਥੋੜਾ ਬਹੁਤਾ ਤਾਂ ਅਸੀਂ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਦੁਬਾਰਾ ਹੀ ਕਰ ਲਈਦਾ ਜਿੰਨਾ ਵੀ ਸਾਡੇ ਕੋ ਪੰਜ ਅਸ਼ਟਪਦੀਆਂ ਹੋ ਜਾਣ ਚਾਰ ਹੋ ਜਾਣ ਜਿੰਨੀਆਂ ਵੀ ਹੋ ਜਾਣ ਉਹ ਅਹੀਂ ਕਰ ਲੈਨੇ ਆਂ ਉਨ੍ਹਾਂ ਨੂੰ ਕੋਈ ਦਿੱਕਤ ਨੀ ਆਉਂਦੀ ਹੈਗੀ ਪਾਠ ਕਰਨੇ ਵਿੱਚ ਹੁਣ ਮਤਲ ਕੋਈ ਮਤਲਬ ਕੀ ਨੀ ਇਸ ਤਰ੍ਹਾਂ ਹੁੰਦਾ ਹੈਗਾ ਪੀ ਪ੍ਰੇਸ਼ਾਨ ਜਾਂ ਹੋਈਏ ਜਾਂ ਕਿਸ ਤਰ੍ਹਾਂ ਵੀ ਕੋਈ ਕੰਮ ਕਰੀਏ ਤੇ ਇਸ ਕਰਕੇ ਅਹੀਂ ਆਪਣਾ ਜੋ ਜਿੰਨਾ ਵੀ ਟਾਈਮ ਬਚਦਾ ਵਾ ਤੇ ਉਹ ਆਪਣੇ ਮਤਲਬ ਕੀ ਪਾਠ ਵਿੱਚ ਹੀ ਟੈਮ ਬਤੀਤ ਜਿਹੜਾ ਉਹ ਕਰ ਦੇਈਦਾ ਵਾ